ਹੈਲੋ ਤੁਸੀਂ ਟੂਰਿਸਟ ਬੋਲ ਰਹੇ ਹੋ ਮੁਕਤਸਰ ਸਾਹਿਬ ਤੋਂ ਟੂਰਿਸਟ ਗਾਇਡ ਸ਼੍ਰੀ ਮੁਕਤਸਰ ਸਾਹਿਬ ਤੋਂ ਐਕਚੁਲੀ ਨਾ ਮੈਂ ਲੁਧਿਆਣੇ ਤੋਂ ਬੋਲ ਰਹੀ ਹੈਗੀ ਹੈਂਗੀ ਬਈ ਮੈਨੂੰ ਪਤਾ ਲੱਗਿਆ ਬਈ ਮੁਕਤਸਰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਮਾਗੀ ਦਾ ਮੇਲਾ ਲੱਗਦਾ ਹੁੰਦਾ ਅਤੇ ਬੜੇ ਵੱਡੇ ਪੱਧਰ 'ਤੇ ਲੱਗਦਾ ਹੁੰਦਾ ਅਤੇ ਮੈਂ ਸੋਚ ਰਹੀ ਹਾਂ ਬਈ ਮੈਂ ਇਸ ਜਨਵਰੀ ਦੇ ਵਿਚ ਮਾਘੀ ਦਾ ਮੇਲਾ ਦੇਖਣ ਆਵਾਂ ਅਤੇ ਮੂੰ ਥੋੜ੍ਹੀ ਬਹੁਤ ਗਾਈਡੈਂਸ ਦੇ ਸਕਦੇ ਹੋ ਉਹਨਾਂ ਦੀ ਹਿਸਟਰੀ ਬਾਰੇ ਹਾਂਜੀ ਹਾਂਜੀ ਥੋੜ੍ਹੇ ਤੁਸੀਂ ਮੈਨੂੰ ਮਾੜਾ ਜਿਹਾ ਉਹਦੀ ਹਿਸਟਰੀ ਬਾਰੇ ਦੱਸ ਸਕਦੇ ਹੋ

ਹਾਂਜੀ

ਹਾਂਜੀ

ਅੱਛਾ ਹਾਂਜੀ ਠੀਕ ਹੈ

ਠੀਕ ਹੈ ਠੀਕ ਹੈ

ਠੀਕ ਹੈ ਫਿਰ ਮੇਰਾ ਇੱਥੇ ਆਉਣ ਦਾ ਡਿਸੀਜ਼ਨ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਬਈ ਮੈਨੂੰ ਇੰਟਰਸਟ ਜਿਹਾ ਪੈ ਗਿਆ ਬਈ ਹੁਣ ਮੈਂ ਜ਼ਰੂਰ ਆਉਂਗੀ ਇਹ ਮਲ ਮਾਘੀ ਦਾ ਮੇਲਾ ਦੇਖਣ ਬਈ ਤੁਸੀਂ ਵਧੀਆ ਤਰੀਕੇ ਦੇ ਨਾਲ ਗਾਇਡ ਕੀਤਾ

ਠੀਕ ਹੈ ਬਈ ਅਗਰ ਮੈਂ ਇਥੇ ਮਾਘੀ ਦਾ ਮੇਲਾ ਦੇਖਣ ਆਉਗੀ ਤਾਂ ਤੁਸੀਂ ਬਈ ਮੇਰੇ ਮੈਨੂੰ ਐਜ਼ ਆ ਗਾਈਡੈਂਸ ਗਾਈਡ ਗਾਈਡਿੰਗ ਪ੍ਰੋਵਾਈਡ ਕਰ ਸਕਦੇ ਹੋ ਨਾ

ਠੀਕ ਹੈ ਜੀ ਓਕੇ